ਮੇਰੇ ਜਿਲ੍ਹੇ ਦੇ ਵਿੱਚ ਇੱਕ ਬਹੁਤ ਹੀ ਵੱਡਾ ਪ੍ਰਚੂਨ ਬਾਜ਼ਾਰ ਬਣਿਆ ਹੋਇਆ ਹੈ ਜਿੱਥੋਂ ਕਿ ਆਮ ਤੌਰ 'ਤੇ ਮਨੁੱਖ ਆਪਣੇ ਘਰ ਦਾ ਸਾਰਾ ਸੌਦਾ ਖਰੀਦਦੇ ਹਨ ਉੱਥੇ ਬਹੁਤ ਹੀ ਆਸਾਨੀ ਦੇ ਨਾਲ ਲੋਕਾਂ ਨੂੰ ਘਰ ਦੀ ਵਰਤੋਂ ਦੀਆਂ ਚੀਜ਼ਾਂ ਜਿਵੇਂ ਕਿ ਸਾਬਣ ਸਰਫ ਕਰਿਆਨੇ ਦਾ ਸਾਰਾ ਸਮਾਨ ਦਾਲਾਂ ਤੋਂ ਲੈ ਕੇ ਜਿਵੇਂ ਵੀ ਛੋਲੇ ਹਰ ਤਰਾਂ ਦੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਜਿੱਦਾਂ ਕਿ ਜਾਣਦੇ ਹਾਂ ਕਿ ਅਸੀਂ ਜਿੱਦਾਂ ਜਿੱਦਾਂ ਸਮਾਂ ਅੱਗੇ ਵੱਧ ਰਿਹਾ ਹੈ ਚੀਜ਼ਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ ਅਖਰੋਟ ਬਦਾਮ ਕਾਜੂ ਇਹਨਾਂ ਦੀਆਂ ਕੀਮਤਾਂ ਆਸਮਾਨਾਂ ਨੂੰ ਛੂਹ ਰਹੀਆਂ ਹਨ ਅਤੇ ਸਬਜ਼ੀਆਂ ਦੇ ਰੇਟ ਵੀ ਹੌਲੀ ਹੌਲੀ ਵੱਧ ਰਹੇ ਹਨ ਤਾਂ ਕਰਕੇ ਰੇਟਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ ਜਦੋਂ ਅਸੀਂ ਔਨਲਾਈਨ ਖਰੀਦਦਾਰੀ ਬਾਰੇ ਗੱਲ ਕਰਦੇ ਹਾਂ ਤਾਂ ਇਹ ਉਨ੍ਹਾਂ ਲੋਕਾਂ ਵਾਸਤੇ ਬਹੁਤ ਹੀ ਵਧੀਆ ਹੈ ਜਿਨ੍ਹਾਂ ਕੋਲ ਬਹੁਤ ਘੱਟ ਸਮਾਂ ਹੁੰਦਾ ਹੈ ਆਪਣੇ ਕੰਮ ਤੋਂ ਬਾਅਦ ਆ ਕੇ ਘਰ ਦੀ ਖਰੀਦਦਾਰੀ ਕਰਨ ਦੇ ਲਈ ਅਤੇ ਇਹਦਾ ਮਾੜਾ ਪ੍ਰਭਾਵ ਸਾਰਾ ਇਹੀ ਹੈ ਕਿ ਲੋਕ ਇੱਕ ਦੂਸਰੇ ਦੇ ਨਾਲ ਵਿਚਰਨਾ ਭੁੱਲ ਜਾਂਦੇ ਹਨ ਅਤੇ ਕਈ ਵਾਰ ਅਸੀਂ ਆਪਣੇ ਸਮਾਨ ਜਿਹਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਫਿਰ ਉਹਨੂੰ ਵਾਪਸ ਕਰਨਾ ਵੀ ਸਾਡੇ ਲਈ ਮੁਸ਼ਕਲ ਹੋ ਜਾਂਦਾ ਹੈ ਚੰਗੀ ਗੱਲ ਇਸਦੀ ਇਹੀ ਹੈ ਕਿ ਸਾਨੂੰ ਬਹੁਤ ਹੀ ਆਸਾਨੀ ਨਾਲ ਘਰ ਬੈਠਿਆਂ ਹੀ ਆਪਣਾ ਹਰ ਜੋ ਵੀ ਅਸੀਂ ਸਾਨੂੰ ਚੀਜ਼ ਚਾਹੀਦੀ ਹੈ ਮਿਲ ਜਾਂਦੀ ਹੈ ਸਾਨੂੰ ਬਾਹਰ ਜਾ ਕੇ ਕੁਝ ਵੀ ਖਰੀਦਣ ਦੀ ਲੋੜ ਨਹੀਂ ਪੈਂਦੀ ਘਰ ਬੈਠਿਆ ਬਿਠਾਇਆ ਸਭ ਹੋ ਜਾਂਦਾ ਹੈ ਧੰਨਵਾਦ